ਸਾਡਾ ਭਾਈਚਾਰਾ ਹੈ ਧਾਰਮਿਕ ਅਸੀਂ ਜਦੋਂ ਵੀ ਟੀ ਵੀ ਲਗਾਉਂਦੇ ਹਾਂ ਸਵੇਰੇ ਉੱਠਦੇ ਹਾਂ ਪਹਿਲਾਂ ਅਸੀਂ ਟੀ ਵੀ ਲਗਾਉਂਦੇ ਹਾਂ ਕਿ ਸਾਨੂੰ ਉਹਦਾ ਪ੍ਰਚਾਰ ਸੁਣਨਾ ਅਸੀਂ ਆਪਣਾ ਟੀ ਵੀ ਚੈਨਲ ਲਗਾ ਕੇ ਅਸੀਂ ਗੋਰੀ ਗੋਪਾਲ ਦਾ ਪ੍ਰਚਾਰ ਸੁਣਦੇ ਹਾਂ ਸਾਨੂੰ ਬਹੁਤ ਸ਼ਾਂਤੀ ਮਿਲਦੀ ਹੈ ਉਹ ਸੁਣ ਕੇ ਅਸੀਂ ਕਾਫ਼ੀ ਬੈਠ ਕੇ ਸਵੇਰੇ ਅਸੀਂ ਨਹਾ ਧੋ ਕੇ ਅਸੀਂ ਧੂਫ ਬੱਤੀ ਕਰਕੇ ਅਸੀਂ ਬੈਠ ਕੇ ਉਹਨਾਂ ਦੀ ਭਗਤੀ ਸੁਣਦੇ ਹਾਂ ਅਸੀਂ ਦੋ ਘੰਟੇ ਜਾਂ ਤਿੰਨ ਘੰਟੇ ਬੈਠ ਕੇ ਜਿੰਨਾ ਵੀ ਉਹਨਾਂ ਕਰਨਾ ਹੁੰਦਾ ਅਸੀਂ ਸੁਣਦੇ ਹਾਂ ਸੁਣ ਕੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਫਿਰ ਜੋ ਵੀ ਉਹ ਦੱਸਦੇ ਆ ਅਸੀਂ ਉਸ ਅਸੀਂ ਉਹ ਹੀ ਕਰਦੇ ਹਾਂ ਸਾਨੂੰ ਬੜੀ ਸ਼ਾਂਤੀ ਸਾਡਾ ਪਰਿਵਾਰ ਪੂਰਾ ਸਾਡੀ ਸ਼ਾਂਤੀ ਵੀ ਮਿਲਦੀ ਹੈ ਸਾਡੇ ਪੂਰੇ ਪਰਿਵਾਰ ਨੂੰ ਅਸੀਂ ਕੰਮਾਂ ਵਿੱਚ ਲੱਗੇ ਰਹਿੰਦੇ ਹਾਂ ਸਾਡਾ ਕੰਮ ਸੁਣ ਕੇ ਜੋ ਵੀ ਅਸੀਂ ਮੰਦਰ 'ਚ ਜਾਂਦੇ ਹਾਂ ਜਿੱਥੇ ਵੀ ਜਾਂਦੇ ਆ ਸ਼ਾਂਤੀ ਮਿਲਦੀ ਹੈ ਤਾਂ ਕਿ ਸਾਡਾ ਕੰਮ ਸਫਲ ਹੋ ਸਕੇ ਫਿਰ ਅਸੀਂ ਆਪਣੇ ਪਰਿਵਾਰ ਨੂੰ ਸਲਾਹ ਦਿੰਦੇ ਹਾਂ ਕਿ ਅਸੀਂ ਇਹ ਸੁਨੇਹਾ ਤੁਸੀਂ ਇਹ ਕੰਮ ਕਰੋ ਤੁਹਾਡਾ ਸਫਲ ਹੋ ਜਾਵੇਗਾ ਹਰ ਕੰਮ ਸਿੱਧਾ ਹੋ ਜਾਵੇਗਾ ਜੋ ਵੀ ਇਹ ਸਾਨੂੰ ਦਿੰਦਾ ਹੈ ਸੁਭਾਅ ਸਿੱਖ ਸਲਾਹ ਹੁੰਦੀ ਹੈ ਜੋ ਵੀ ਸਾਡੀ ਜੋ ਸਾ ਵੀ ਗੋਰੀ ਗੋਪਾਲ ਨੇ ਸਾਨੂੰ ਦੱਸਣਾ ਹੁੰਦਾ ਸੁਣਦੇ ਹਾਂ ਦਿਮਾਗ 'ਚ ਬਿਠਾਉਂਦੇ ਵੀ ਹਾਂ ਫਿਰ ਅਸੀਂ ਕਰਦੇ ਵੀ ਹਾਂ ਕਰ ਕੇ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਡਾ ਹਰ ਕੰਮ ਹੁੰਦਾ ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਅਸੀਂ ਆਪਣਾ ਇਹਨਾਂ ਦਾ ਆਸ਼ੀਰਵਾਦ ਲੈਂਦੇ ਹਾਂ ਕਿ ਅਸੀਂ ਬਾਹਰ ਕੋਈ ਵੀ ਕੰਮ ਕਰਨ ਚੱਲੇ ਹਾਂ ਸਾਡਾ ਸ਼ੁੱਭ ਕੰਮ ਹੋਵੇ ਤਾਂ ਕਿ ਸਾਨੂੰ ਕੋਈ ਵੀ ਸਾਡਾ ਨੁਕਸਾਨ ਨਾ ਹੋਵੇ ਸਾਡਾ ਸਭ ਕੁਝ ਸਹੀ ਸਲਾਮਤ ਹੋਵੇ ਪਰਿਵਾਰ ਵੀ ਸਾਰੇ ਸੁੱਖ ਸ਼ਾਂਤੀ ਮੰਗਦੇ ਹਾਂ ਅਸੀਂ ਫਿਰ ਸਾਡੇ ਕੋਈ ਵੀ ਘਰ ਵਿੱਚ ਪਰਿਵਾਰ ਕੋਈ ਸਾਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਇੱਦਾਂ ਕਰਨਾ ਹੈ ਉਹਨਾਂ ਦੀ ਆਗਿਆ ਅਸੀਂ ਲੈਂਦੇ ਹਾਂ ਉਹਨਾਂ ਦੇ ਆਗਿਆਕਾਰੀ ਹੁੰਦੇ ਹਾਂ ਧੰਨਵਾਦ